ਸਾਡੇ ਏਰੀਏ ਵਿੱਚ ਕਸਟਮਰ ਸਰਵਿਸ ਦੀ ਕਾਫੀ ਲੋੜ ਹੈ ਕਿਉਂਕਿ ਸਾਡਾ ਏਰੀਆ ਸ਼ਹਿਰ ਨਾਲੋਂ ਕਾਫੀ ਦੂਰ ਪੈ ਜਾਂਦਾ ਹੈ ਅਤੇ ਜੇ ਆਪਾਂ ਕੁਛ ਮੰਗਾਉਣਾ ਹੋਵੇ ਉਸਦੀ ਅਤੇ ਉਸ ਵਿੱਚ ਕੋਈ ਸਮੱਸਿਆ ਆਏ ਤਾਂ ਉਸ ਦੀ ਕੰਪਲੇਨ ਕਰਨ ਲਈ ਸਾਨੂੰ ਕਾਫੀ ਸਮ ਸਮਾਂ ਲੱਗ ਜਾਂਦਾ ਹੈ ਇਸ ਵਿੱਚ ਕ ਕਸਟਮਰ ਸਰਵਿਸ ਸਿਸਟਮ ਸਾਡੀ ਕਾਫੀ ਹੈਲਪ ਮਦਦ ਕਰਦਾ ਹੈ ਜਿਸ ਕਾਰਨ ਸਾਡਾ ਕੰਮ ਸੌਖਾ ਹੋ ਜਾਂਦਾ ਹੈ ਅਤੇ ਸਾਨੂੰ ਜ਼ਿਆਦਾ ਵਕਤ ਨਹੀਂ ਬਰਬਾਦ ਕਰਨਾ ਪੈਂਦਾ ਔਰ ਇਸ ਤੋਂ ਇਲਾਵਾ ਅੱਜ ਕੱਲ੍ਹ ਕਾਫੀ ਬਜ਼ੁਰਗ ਬੰਦੇ ਵੀ ਫੋਨ ਵਰਤਦੇ ਹਨ ਪਰ ਉਹਨਾਂ ਨੂੰ ਸਾਰੀ ਚੀਜ਼ਾਂ ਨਹੀਂ ਆਉਂਦੀਆਂ ਇਸ ਲਈ ਉਹਦੇ ਲਈ ਵੀ ਕਸਟਮਰ ਸਰਵਿਸ ਸਿਸਟਮ ਕਾਫੀ ਵਧੀਆ ਚੀਜ਼ ਹੈ ਜਿਸ ਕਰਕੇ ਉਹ ਆਪਣੀ ਸਮੱਸਿਆ ਲੋਕ ਕਸਟਮਰ ਸਰਵਿਸ ਅੱਗੇ ਰੱਖ ਸਕਦੇ ਨੇ ਅਤੇ ਉਸਦਾ ਕੋਈ ਹੱਲ ਪਾ ਸਕਦੇ ਹਨ ਇਸ ਤੋਂ ਇਲਾਵਾ ਜੇ ਦੇਖਿਆ ਜਾਏ ਤਾਂ ਸਾਡੇ ਇੱਧਰ ਸਰਚ ਇੰਜਨ ਓਪ ਦੀ ਵੀ ਕਾਫੀ ਲੋੜ ਹੈ ਜੋ ਸਾਡਾ ਏਰੀਆ ਵਿੱਚ ਲੋਕਾਂ ਨੂੰ ਦੱਸੇਗਾ ਕਿ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਅਤੇ ਉਹ ਆਸਾਨੀ ਨਾ ਉਸ ਚੀਜ਼ ਨੂੰ ਸਰਚ ਕਰਕੇ ਉਸ 'ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਇਸ ਤੋਂ ਇਲਾਵਾ ਜੇ ਦੇਖਿਆ ਜਾਏ ਤਾਂ ਫਾਇਰਬੋਲ ਸਕਿਲਸ ਵਗੈਰਾ ਦੀ ਵੀ ਕਾਫੀ ਜ਼ਰੂਰਤ ਹੈ ਜਿਸ ਨਾਲ ਆਪਾਂ ਆਪਣਾ ਇੱਧਰ ਦਾ ਸਿਸਟਮ ਵਧੀਆ ਕਰ ਸਕੀਏ ਅਤੇ ਉਹ ਗਲਤ ਹੱਥਾਂ ਤੋਂ ਪੈਣ ਤੋਂ ਬਚਾ ਸਕੀਏ ਜਿੱਦਾਂ ਉਹਨੂੰ ਹੈਕ ਹੋਣ ਤੋਂ ਆਪਾਂ ਰੋਕ ਸਕਦੇ ਹਾਂ ਜੇ ਸਾਡਾ ਫਾਇਰਬਾਲ ਸਿਸਟਮ ਵਧੀਆ ਹੋਇਆ ਅਤੇ ਇਸ ਲਈ ਵੀ ਤਾਂ ਦੇਖਿਆ ਜਾਏ ਤਾਂ ਬਾਅਦ ਵਿੱਚ ਸਾਨੂੰ ਕਸਟਮਰ ਸਰਵਿਸ ਦੀ ਤਾਂ ਲੋੜ ਪੈਂਦੀ ਹੀ ਹੈ ਕਿਉਂਕਿ ਉਹ ਸਾਡੇ ਰੋਜ਼ੀ ਰੋਜ਼ ਦੇ ਕੰਮ ਲਈ ਕਾਫੀ ਮਦਦ ਕਰਦਾ ਹੈ ਜਿਵੇਂ ਜੇ ਕਿਸੇ ਵੈਬਸਾਈਟ ਤੋਂ ਆਪਾਂ ਕੁਛ ਮੰਗਵਾਇਆ ਤਾਂ ਉਸਨੂੰ ਰਿਟਰਨ ਕਰਨਾ ਜਾਂ ਰਿਫੰਡ ਕਰਨਾ ਇਸ ਨਾਲ ਸੌਖਾ ਹੋ ਜਾਂਦਾ ਹੈ